ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਪੰਜਾਬ ਦੇ ਵਿੱਚ ਨੱਚਦੇ ਸਮੇਂ ਲੋਕ ਅਲੱਗ ਅਲੱਗ ਤਰ੍ਹਾਂ ਦੇ ਪਹਿਰਾਵੇ ਪਹਿਨਦੇ ਹਨ ਜਾਂ ਕਹਿ ਸਕਦੇ ਹਾਂ ਕਿ ਪੂਰੇ ਭਾਰਤ ਦੇ ਵਿੱਚ ਵੀ ਲੋਕ ਅਲੱਗ ਅਲੱਗ ਨੱ ਅਲੱਗ ਅਲੱਗ ਥਾਵਾਂ 'ਤੇ ਅਲੱਗ ਅਲੱਗ ਪ੍ਰੋਗਰਾਮਾਂ 'ਤੇ ਨੱਚਣ ਸਮੇਂ ਅਲੱਗ ਅਲੱਗ ਤਰ੍ਹਾਂ ਦੀਆਂ ਪੋਸ਼ਾਕਾਂ ਅਤੇ ਅਲੱਗ ਅਲੱਗ ਤਰ੍ਹਾਂ ਦੇ ਪਹਿਰਾਵੇ ਪਹਿਨਦੇ ਹਨ ਜਿਵੇਂ ਕਿ ਪੰਜਾਬ ਦੇ ਵਿੱਚ ਭੰਗੜਾ ਪੈਣ ਦੇ ਸਮੇਂ ਲੋਕ ਚਾਦਰਾ ਕੁੜਤਾ ਗਲੇ ਵਿੱਚ ਕੈਂਠਾ ਅਤੇ ਸਿਰ 'ਤੇ ਤੁਰਲੇ ਵਾਲੀ ਪੱਗ ਪਹਿਨਦੇ ਹਨ ਅਤੇ ਉਸ ਤਰ੍ਹਾਂ ਹੀ ਜੇਕਰ ਕੋਈ ਪੋਪ ਡਾਂਸ ਨੂੰ ਲੈ ਲਈਏ ਆਪਾਂ ਪੋਪ ਡਾਂਸ ਦੇ ਵਿੱਚ ਜਿਹੜੇ ਲੋਕ ਨੇ ਉਹ ਪੈਂਟ ਸ਼ਰਟ ਅਤੇ ਲੇਡੀਜ਼ ਜ਼ਿਆਦਾਤਰ ਟੋਪ ਅਤੇ ਕੰਨਾਂ ਦੇ ਵਿੱਚ ਵਾਲੀਆਂ ਪਹਿਨਦੀਆਂ ਹਨ ਅਤੇ ਭੰਗੜਾ ਕਰਨ ਸਮੇਂ ਲੇਡੀਜ਼ ਸਲਵਾਰ ਕੁੜਤੀ ਸਿਰ 'ਤੇ ਸੱਗੀ ਫੁੱਲ ਦੁਪੱਟਾ ਇਸ ਤਰ੍ਹਾਂ ਦੇ ਪਹਿਰਾਵੇ ਪਹਿਨਦੀਆਂ ਹਨ ਰਵਾਇਤੀ ਕੱਪੜਿਆਂ ਦੇ ਜਿਵੇਂ ਚਾਦਰਾ ਕੁੜਤਾ ਪੈਂਟ ਸ਼ਰਟ ਧੋਤੀ ਕੁੜਤਾ ਗਹਿਣਿਆਂ ਦੇ ਨਾਮ ਜਿਵੇਂ ਹੋ ਗਏ ਕੈਂਠਾ ਸੱਗੀ ਫੁੱਲ ਹੋਰ ਵੀ ਅਲੱਗ ਅਲੱਗ ਤਰ੍ਹਾਂ ਦੇ ਪਹਿਰਾਵੇ ਪਹਿਨੇ ਜਾਂਦੇ ਹਨ ਧੰਨਵਾਦ